ਭੰਗੜੇ ਲਈ ਮੁੰਡਿਆਂ ਲਈ ਕੁੜਤਾ ਚਾਦਰਾ ਇੱਕ ਉਹਨਾਂ ਦੇ ਭੰਗੜੇ ਨੂੰ ਚਾਰ ਚਾਂਦ ਲਾਉਣ ਵਾਲੀ ਡਰੈਸ ਹੈ ਅਤੇ ਕੁੜੀਆਂ ਲਈ ਸਲਵਾਰ ਸੂਟ ਜੋ ਕਿ ਉਹਨਾਂ ਦਾ ਪਹਿਰਾਵਾ ਹੀ ਇੰਨਾ ਵਧੀਆ ਲੱਗਦਾ ਹੈ ਕਿ ਆਪਣੇ ਭੰਗੜੇ ਨੂੰ ਚਾਰ ਚਾਂਦ ਲਗਾ ਦਿੰਦਾ ਹੈ ਜੋ ਕਿ ਭੰਗੜਾ ਪਾਉਣ ਤੋਂ ਪਹਿਲਾਂ ਹੀ ਉਹਨਾਂ ਦੀ ਡਰੈੱਸ ਦੇਖ ਕੇ ਆਪਣਾ ਮਨ ਖੁਸ਼ ਹੋ ਜਾਂਦਾ ਹੈ ਅਤੇ ਭੰਗੜੇ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਚਾਂਦ ਲੱਗ ਜਾਂਦੀ ਹੈ ਅਤੇ ਆਪਣਾ ਦਿਲ ਕਰਦਾ ਵੀ ਆਪਾਂ ਉਹਨਾਂ ਦੀ ਡਰੈਸ ਦੇਖੀ ਹੀ ਜਾਈਏ